ਹੈਲੋ ਹਾਂਜੀ ਮੈਮ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ ਠੀਕ ਆ ਮੈਮ ਮੈਮ ਤੁਸੀਂ ਤੁਹਾਨੂੰ ਕੋਈ ਪਤਾ ਆ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਤੁਸੀਂ ਘੁੰਮਣਾ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਗਾਈਡ ਮਤਲਬ ਕਿ ਦੱਸੀਏ ਕਿ ਆਹ ਵਾਲੀਆਂ ਜਗ੍ਹਾ ਹੈਗੀਆਂ ਜਾਂ ਤੁਸੀਂ ਸਪੈਸੀਫਿਕ ਕ ਕੋਈ ਦੱਸਣਾ ਚਾਹੁੰਦੇ ਆ ਕਿ ਆਹ ਵਾਲੀ ਜਗ੍ਹਾ 'ਤੇ ਮੈਂ ਜਾਣਾ ਚਾਹੁੰਦੀ ਹਾਂ ਠੀਕ ਹੈ ਮੈਮ ਮਤਲਬ ਤੁਸੀਂ ਇੱਕ ਹਫ਼ਤੇ ਲਈ ਆਉਣਾ ਚਾਹੁੰਦੇ ਹੋ ਅਤੇ ਤੁਸੀਂ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਘੁੰਮਣਾ ਚਾਹੁੰਦੇ ਓਂ ਮੈਮ ਜੇ ਅਸੀਂ ਦੇਖੀਏ ਤਾਂ ਜੋ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉੱਥੇ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਦੇਖਣਾ ਚਾਹੁੰਦੇ ਹੈ ਤਾਂ ਤੁਸੀਂ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰੋ ਠੀਕ ਹੈ ਅਤੇ ਉਹ ਤੋਂ ਬਾਅਦ ਜੇ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰ ਲਏ ਤਾਂ ਤੁਸੀਂ ਜਲ੍ਹਿਆਂਵਾਲਾ ਬਾਗ ਜਾ ਸਕਦੇ ਹੋ ਠੀਕ ਹੈ ਜਿੱਥੇ ਸਾਡੇ ਸਾਰੇ ਜੋ ਵੀ ਸ਼ਹੀਦ ਏ ਆ ਉਹਨਾਂ ਨੂੰ ਨ ਨਤਮਸਤਕ ਕਰੋ ਜਾ ਕੇ ਅਤੇ ਉਹ ਤੋਂ ਬਾਅਦ ਇੱਕ ਬਾਘਾ ਬੋਰਡਰ ਹੈਗਾ ਆ ਤੁਸੀਂ ਉੱਧਰ ਵੀ ਜਾ ਸਕਦੇ ਓਂ ਅਤੇ ਉਸ ਤੋਂ ਬਾਅਦ ਮੈਮ ਇੱਥੇ ਦੋ ਹਵੇਲੀਆਂ ਵੀ ਹੈਗੀਆਂ ਇੱਕ ਨਵੀਂ ਅਤੇ ਪੁਰਾਣੀ ਅਤੇ ਜੇ ਤੁਸੀਂ ਵਿੱਚ ਕਿਤੇ ਸਟੇਅ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਤੁਹਾਨੂੰ ਬਹੁਤ ਵਧੀਆ ਪ੍ਰੋਵਾਈਡ ਜੋ ਵੀ ਸਾਡਾ ਹੈਗਾ ਆ ਅਸੀਂ ਪ੍ਰੋਵਾਈਡ ਕਰਾਂਗੇ ਵਧੀਆ ਰੈਸਟੋਰੈਂਟ ਪ੍ਰੋਵਾਈਡ ਕਰਾਂਗੇ ਤੁਹਾਡਾ ਖਾਣਾ ਪੀਣਾ ਜੋ ਵੀ ਉਹ ਵੀ ਚੱਕਾਗੇ ਅਸੀਂ ਅਤੇ ਮੈਮ ਜੇ ਅਸੀਂ ਉਹਦੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਸਾਡੇ ਜਿਹੜੇ ਦੋ ਤਿੰਨ ਇਤ ਇਤਿਹਾਸਿਕ ਗੁਰਦੁਆਰੇ ਹੈਗੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਉੱਧਰ ਬਾਬਾ ਗੁਰਦਿੱਤਾ ਜੀ ਦੇ ਨਾਲ਼ ਵੀ ਹੈਗੇ ਬਾਬਾ ਬੁੱਢੜ ਸ਼ਾਹ ਅਤੇ ਵਿਰਾਸਤ ਏ ਖਾਲਸਾ ਬਹੁਤ ਦੇਖਣੇ ਵਾਲਾ ਆ ਮੈਮ ਅਤੇ ਤੁਸੀਂ ਉਹਨਾਂ ਥਾਵਾਂ 'ਤੇ ਵੀਜਿਟ ਕਰ ਸਕਦੇ ਓਂ